ਇੱਕ ਜਨਵਰੀ ਦੋ ਹਜ਼ਾਰ ਦੋ ਉੱਨੀ ਅਗਸਤ ਦੋ ਹਜ਼ਾਰ ਉੱਨੀ ਪੱਚੀ ਮਈ ਉੱਨੀ ਸੌ ਅੱਸੀ ਤੀਹ ਜੂਨ ਉੱਨੀ ਸੌ ਨੜ੍ਹਿਨਵੇਂ ਚਾਰ ਅਪ੍ਰੈਲ ਦੋ ਹਜ਼ਾਰ ਇੱਕ